ਮੈਂ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਰਹਿੰਦੀ ਹਾਂ ਅਤੇ ਉੱਥੇ ਮੈਂ ਅਤੇ ਇੱਕ ਵਾਰੀ ਮੈਂ ਮਤਲਬ ਉਹਨਾਂ ਦੇ ਤੇ ਇੱਥੇ ਇੰਨਦੇ ਘਰ ਹੈ ਅਤੇ ਮਿਊਜ਼ੀਅਮ ਮਿਊਜ਼ੀਅਮ ਹੈ ਅਤੇ ਪਾਰਕ ਹੈ ਮੈਂ ਉੱਥੇ ਗਈ ਸੀਗੀ ਅਤੇ ਉਥੇ ਉਹਨਾਂ ਦੇ ਮਤਲਬ ਮੰਜੇ ਵਗੈਰਾ ਪਏ ਹੋਏ ਸੀਗੇ ਮਤਲਬ ਖ ਖਿਡੌਣੇ ਵਗੈਰਾ ਸੀਗੇ ਅਤੇ ਇੱਕ ਉਸ ਤੋਂ ਬਾਅਦ ਮਤਲਬ ਕਿ ਨਾ ਜੇ ਮੈਨੂੰ ਅੱਜ ਵੀ ਯਾਦ ਆ ਮੈਂ ਜਦੋਂ ਛੋਟੇ ਮਤਲਬ ਜਦੋਂ ਸਕੂ ਮਤਲਬ ਸਕੂਲ 'ਚ ਪੜ੍ਹਦੇ ਹੁੰਦੇ ਸੀਗੇ ਉਦੋਂ ਹੈ ਨਾ ਨਿਆਣਿਆਂ ਦੇ ਟੂਰ ਵਗੈਰਾ ਲੱਗਦੇ ਹੁੰਦੇ ਸੀਗੇ ਅਤੇ ਲੈ ਕੇ ਜਾਂਦੇ ਹੁੰਦੇ ਸੀਗੇ ਅਤੇ ਨਿਆਣੇ ਉੱਥੇ ਜਾ ਕੇ ਕਾਫੀ ਇੰਜੋਇਮੈਂਟ ਵਗੈਰਾ ਕਰਦੇ ਹੁੰਦੇ ਸੀਗੇ ਦੇਖਦੇ ਹੁੰਦੇ ਸੀਗੇ ਕਿ ਹਾਂ ਮਤਲਬ ਉਹਨਾਂ ਨੇ ਕਾਫੀ ਛੋਟੀ ਏ ਏਜ ਦੇ ਵਿੱਚ ਮਤਲਬ ਦੇਸ਼ ਨੂੰ ਆਜ਼ਾਦ ਕਰਵਾਇਆ ਸੀਗਾ ਅਤੇ ਮਤਲਬ ਕਾਫੀ ਵਧੀਆ ਮਤਲਬ ਮੈਂ ਉੱਥੇ ਕਾਫੀ ਕੁਝ ਦੇਖਣ ਨੂੰ ਅਤੇ ਸਿੱਖਣੇ ਨੂੰ ਵੀ ਮਿਲਦਾ ਆ ਤੇ ਇੱਕ ਵਾਰੀ ਮੈਂ ਉਥੇ ਗੁਰਦੁਆਰੇ ਚ ਵੀ ਗਈ ਸੀ ਤੇ ਮੈਂ ਨਾ ਇਸ ਚੀਜ਼ ਤੋਂ ਕਾਫੀ ਇੰਸਪਾਇਰ ਹੁੰਦੀ ਹਾਂ